ਹਾਂ ਸਰ ਮੈਂ ਨਾ ਤੁਹਾਡੇ ਉਹ 'ਤੇ ਸ਼ੋਪ 'ਤੇ ਬੱਲਬਸ ਔਡਰ ਕੀਤੇ ਸੀਗੇ ਔਨਲਾਈਨ ਅੱਜ ਪਹਿਲਾਂ ਤਾਂ ਤੁਸੀਂ ਔਡਰ ਹੀ ਬਹੁਤ ਲੇਟ ਭੇਜਿਆ ਅਤੇ ਅੱਜ ਜਦੋਂ ਮੈਂ ਔਡਰ ਰਿਸੀਵ ਕੀਤਾ ਤਾਂ ਇਹਦੇ ਵਿੱਚੋਂ ਕਾਫੀ ਡਿਫੈਕਟਿਡ ਪੀਸ ਹੈ ਤਿੰਨ ਬੱਲਬ ਤਾਂ ਪੂਰੀ ਤਰ੍ਹਾਂ ਟੁੱਟੇ ਹੀ ਹੋਏ ਹੈ ਅਤੇ ਦੋ ਬੱਲਬ ਨੂੰ ਜਦੋਂ ਮੈਂ ਚੈੱਕ ਕੀਤਾ ਲਗਾ ਕੇ ਪਲੱਗ ਦੇ ਨਾਲ ਤਾਂ ਉਹ ਚੱਲ ਨਹੀਂ ਰਹੇ ਦੇਖੋ ਇੰਨੇ ਐਕਸਪੈਂਸਿਵ ਬੱਲਬ ਸੀਗੇ ਅਤੇ ਇਹ ਕੋਈ ਬਹੁਤ ਅੱਛਾ ਐਕਸਪੀਰੀਅੰਸ ਮੇਰਾ ਨਹੀਂ ਰਿਹਾ ਬਹੁਤ ਮਾੜਾ ਐਕਸਪੀਰੀਅੰਸ ਰਿਹਾ ਤਾਂ ਮੈਂ ਤੁਹਾਡੇ ਤੋਂ ਇਹ ਚਾਹੁੰਦੀ ਹਾਂ ਕਿ ਮੈਂ ਜੋ ਤੁਹਾਨੂੰ ਪੇਮੈਂਟ ਕੀਤੀ ਹੈ ਇਹਨਾਂ ਬੱਲਬਸ ਦੀ ਤੁਸੀਂ ਉਹਨਾਂ ਨੂੰ ਮੇਰੇ ਪੈਸਿਆਂ ਨੂੰ ਰਿਫੰਡ ਕਰ ਦਿਉ ਇਹ ਮੇਰੇ ਪੈਸੇ ਤੁਸੀਂ ਮੇਰੇ ਬੈਂਕ ਅਕਾਊਂਟ 'ਚ ਪਾ ਦਿਉ ਜਾਂ ਮੇਰੀ ਪੇਟੀਐੱਮ ਐਪ ਜਿੱਥੋਂ ਮੈਂ ਤੁਹਾਨੂੰ ਪੇਅ ਕੀਤੇ ਸੀਗੇ ਬੈਕ ਟੂ ਸੋਰਸ ਤੁਸੀਂ ਉਹਦੇ ਵਿੱਚ ਮੇਰੇ ਪੈਸੇ ਰਿਫੰਡ ਕਰ ਦਿਉ ਮੈਂ ਕਿਸੇ ਵੋਲੇਟ ਵਗੈਰਾ ਦੇ ਵਿੱਚ ਐਡ ਨਹੀਂ ਕਰਵਾਉਣੇ ਇਹ ਮੇਰਾ ਐਕਸਪੀਰੀਅੰਸ ਬਹੁਤ ਮਾੜਾ ਰਿਹਾ ਇਹਦੇ ਕਰਕੇ ਮੈਨੂੰ ਤੁਹਾਡੇ ਕਾਫੀ ਨੈਗੇਟਿਵ ਰਿਵਿਊ ਦੇਣਾ ਪਵੇਗਾ ਔਨਲਾਈਨ ਹਾਲੇ ਅਗਰ ਤੁਸੀਂ ਮੇਰੇ ਪੈਸੇ ਟਾਈਮ ਸਿਰ ਵਾਪਸ ਕਰ ਦਿੱਤੇ ਤਾਂ ਸ਼ਾਇਦ ਮੈਂ ਬਹੁਤ ਜ਼ਿਆਦਾ ਨੈਗੇਟਿਵ ਰਿਵਿਊ ਨਾ ਦੇਵਾਂ ਇੱਕ ਜਾਂ ਦੋ ਸਟਾਰ ਦੇ ਦੇਵਾਂ ਪਰ ਅਗਰ ਮੈਂ ਪੈਸੇ ਨਾ ਰਿਸੀਵ ਕੀਤੇ ਫਿਰ ਮੈਂ ਟੋਟਲੀ ਬਹੁਤ ਨੈਗੇਟਿਵ ਰਿਵਿਊ ਹੈ ਤੁਹਾਡਾ ਮੇਰੇ ਮਨ ਦੇ ਵਿੱਚ ਤੁਹਾਡੇ ਔਨਲਾਈਨ ਪ੍ਰੋਡਕਟ ਦੇ ਅਗੇਂਸਟ ਸੋ ਤੁਸੀਂ ਆਪਣਾ ਇਹ ਪ੍ਰੋਡਕਟ ਵਾਪਸ ਲੈ ਜਾਉ ਅਤੇ ਮੇਰੇ ਪੈਸੇ ਮੈਨੂੰ ਰਿਫੰਡ ਕਰ ਦਿਉ